ਮੇਰਾ ਧਰਮ ਸਿੱਖ ਹੈ ਅਤੇ ਮੇਰਾ ਧਰਮ ਮੈਨੂੰ ਸਮਾਜ ਸੇਵਾ ਕਰਨਾ ਸਿਖਾਉਂਦਾ ਹੈ ਸਿੱਖ ਦਾ ਮਤਲਬ ਹੀ ਸੇਵਾ ਕਰਨ ਵਾਲਾ ਸਿੱਖਣ ਵਾਲਾ ਹੈ ਅਤੇ ਸਾਡਾ ਧਰਮ ਜੋ ਹੈ ਹਰ ਸਮੇਂ ਇਹ ਸੇਵਾ ਲਈ ਸਾਨੂੰ ਤਿਆਰ ਕਰਦਾ ਹੈ ਅਤੇ ਮੈਂ ਵੀ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜੁੜੀ ਹੋਈ ਹਾਂ ਜੋ ਕਿ ਇੱਕ ਨਿਰੋਲ ਸਮਾਜ ਸੇਵੀ ਸੰਸਥਾ ਹੈ ਅਤੇ ਇਸ ਦੇ ਵਿੱਚ ਬਹੁਤ ਸਾਰੇ ਜੋ ਹੈ ਸੇਵਾ ਕਾਰਜ ਕੀਤੇ ਜਾਂਦੇ ਹਨ ਜਿਵੇਂ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਨਾ ਜੇ ਕੋਈ ਬੱਚਾ ਫੀਸ ਨਹੀਂ ਦੇ ਸਕਦਾ ਤਾਂ ਉਸ ਦੀ ਫੀਸ ਦੇਣੀ ਉਹਨਾਂ ਨੂੰ ਕਾਪੀਆਂ ਕਿਤਾਬਾਂ ਆਦਿ ਮੁਹੱਈਆ ਕਰਵਾਉਣੀਆਂ ਅਤੇ ਉਹਨਾਂ ਦੀ ਦਾਖਲੇ ਲਈ ਅਗਵਾਈ ਕਰਨੀ ਅਤੇ ਜੇ ਕੋਈ ਬੱਚਾ ਪੜ੍ਹ ਚੁੱਕਾ ਹੈ ਤਾਂ ਉਸ ਦੀ ਨੌਕਰੀ ਵਿੱਚ ਮਦਦ ਕਰਨੀ ਇਸ ਤੋਂ ਬਿਨਾਂ ਸਮਾਜ ਸੇਵਾ ਸਮਾਜ ਸੁਧਾਰ ਦੇ ਲਈ ਬੱਚਿਆਂ ਦੇ ਕੈਂਪ ਲਗਾਉਣੇ ਅਤੇ ਇਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਅਗਵਾਈ ਕੀਤੀ ਜਾਂਦੀ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਵਾਤਾਵਰਨ ਦੀ ਸੰਭਾਲ ਸਿਹਤ ਸੰਭਾਲ ਅਤੇ ਚੰਗੀਆਂ ਗੱਲਾਂ ਮਾਤਾ ਪਿਤਾ ਦੀ ਸੇਵਾ ਆਦਿ ਕਾਰਜਾਂ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਦੀ ਸਿੱਖਿਆ ਜੋ ਹੈ ਉਹ ਦਿੰਦੇ ਹਾਂ ਅਸੀਂ ਅਤੇ ਇਹ ਕੈਂਪ ਹਰ ਸਾਲ ਆਯੋਜਿਤ ਕੀਤੇ ਜਾਂਦੇ ਹਨ ਇਸ ਤੋਂ ਬਿਨਾਂ ਹਸਪਤਾਲਾਂ ਵਿੱਚ ਜਾ ਕੇ ਜੋ ਮਰੀਜ਼ ਹਨ ਉਹਨਾਂ ਨੂੰ ਫਲ ਫਰੂਟ ਦੇਣੇ ਜੂਸ ਵਗੈਰਾ ਦੇਣੇ ਜਾਂ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨੀ ਇਹ ਕੰਮ ਵੀ ਜੋ ਹੈ ਸਾਡੀ ਸੰਸਥਾ ਦੁਆਰਾ ਕੀਤਾ ਜਾਂਦਾ ਹੈ ਅਤੇ ਕਿਸੇ ਦੀ ਬਿਮਾਰੀ ਵਿੱਚ ਮਦਦ ਕਰਨੀ ਅਤੇ ਉਹਨਾਂ ਨੂੰ ਯੋਗ ਡੋਕਟਰ ਕੋਲ ਲੈ ਕੇ ਜਾਣਾ ਇਸ ਤਰ੍ਹਾਂ ਦੇ ਕੰਮ ਵੀ ਸਾਡਾ ਜੋ ਹੈ ਸਾਡੀ ਸੰਸਥਾ ਦੁਆਰਾ ਕੀਤੇ ਜਾਂਦੇ ਹਨ ਅਤੇ ਮੈਂ ਪੂਰੀ ਕੋਸ਼ਿਸ ਕਰਦੀ ਹਾਂ ਕਿ ਮੈਂ ਪੂਰਾ ਸਮਾਂ ਕੱਢ ਕੇੇ ਇਹਨਾਂ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਅਤੇ ਮੈਂ ਸਮਾਜ ਸੇਵਾ ਜੋ ਹੈ ਉਸ ਨੂੰ ਸਮਰਪਿਤ ਹੋ ਸਕਾਂ ਅਤੇ ਮੈਨੂੰ ਇਸ ਦੇ ਲਈ ਬਹੁਤ ਸਹਿਯੋਗ ਵੀ ਮਿਲਦਾ ਹੈ ਅਤੇ ਮੈਂ ਪੂਰੀ ਤਰ੍ਹਾਂ ਨਾਲ ਇਹ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਮੈਂ ਆਪਣੇ ਕੰਮ ਦੇ ਸਮੇਂ 'ਚੋਂ ਸਮਾਂ ਕੱਢ ਕੇ ਕਿਉਂਕਿ ਮੈਂ ਟੀਚਰ ਹਾਂ ਅਤੇ ਮੇਰੇ ਕੋਲ ਸਮੇਂ ਦੀ ਬਹੁਤ ਕਮੀ ਹੁੰਦੀ ਹੈ ਮੇਰੀਆਂ ਹੋਰ ਵੀ ਘਰੇਲੂ ਜ਼ਿੰਮੇਵਾਰੀਆਂ ਬਹੁਤ ਹਨ ਫਿਰ ਵੀ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਮਾਂ ਕੱਢ ਕੇ ਸਮਾਜ ਸੇਵਾ ਕਰਾਂ